ਹੈਲੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਪੋਰਟਸ ਕਲੱਬ ਬਰਨਾਲਾ ਤੋਂ ਬੋਲਦੇ ਹੋ ਹਾਂਜੀ ਜੀ ਅਸੀਂ ਆਪਦੇ ਬੱਚੇ ਲਾਉਣੇ ਸੀ ਉਰੇ ਦੋ ਹੀ ਆ ਜੀ ਹਾਂਜੀ ਸਾਡੇ ਜੀ ਗਵਾਂਢੀਆਂ ਦੇ ਜਵਾਕ ਗੇਮਾਂ ਕਿਹੜੀਆਂ ਕਿਹੜੀਆਂ ਨੇ ਜੀ ਅਤੇ ਸਵੀਮਿੰਗ ਹੈਗੀ ਹੈ ਜੀ ਫੀਸ ਸਟਕਚਰ ਕੀ ਏ ਜੀ ਤੁਹਾਡਾ ਮੈਂ ਹੰਢਾਏ ਤੋਂ ਬੋਲਦਾ ਜੀ ਬੱਚਿਆਂ ਨੂੰ ਸਿਖਾਉਣੀ ਹੈ ਜੀ ਹਾਂਜੀ ਅਤੇ ਟਾਈਮਿੰਗ ਹਾਂਜੀ ਹਾਂਜੀ ਟਾਈਮਿੰਗ ਦਾ ਵੀ ਦੱਸ ਦਿੰਦੇ ਹਾਂਜੀ ਮੇਰਾ ਤਾਂ ਪੰਜ ਵਜੇ ਵਾਲਾ ਸੈੱਟ ਆਊ ਜੀ ਤੁਸੀਂ ਫ੍ਰੀ ਹੋਉਂਗੇ ਜੀ ਓਦੋਂ ਹਾਂਜੀ ਅਤੇ ਵੀ ਟਰਾਂਸਪੋਰਟ ਵੀ ਦੱਸ ਦਿੰਦੇ ਛੱਡਣ ਕਰਨ ਦਾ ਹੈਗਾ ਜੀ ਵੈਨ ਵੂਨ ਕੋਈ ਠੀਕ ਹੈ ਜੀ ਅਤੇ ਜੀ ਕਰਾਟੇ ਵਾਲੇ ਕੋਈ ਸਰ ਹੈ ਕਿ ਤੁਸੀਂ ਆਪ ਹੀ ਸਿਖਾਉਂਗੇ ਅਤੇ ਕਲੱਬ 'ਚ ਜੀ ਕੋਈ ਕੰਟੀਨ ਹੈਗੀ ਆ ਅੱਛਾ ਸਾਨੂੰ ਵੀ ਗਵਾਂਢੀਆਂ ਨੇ ਦੱਸਿਆ ਸੀ ਤੁਹਾਡੇ ਬਾਰੇ ਹਰਪਾਲ ਸਿੰਘ ਕੇ ਜੀ

ਹਾਂਜੀ ਉਹ ਸਾਡੇ ਸਾਰਾ ਦਿਨ ਵੀ ਫੋਨ ਰੱਖੀ ਚੱਕੀ ਰੱਖਦੇ ਸਕੂਲੋਂ ਆ ਕੇ ਓਹ ਬਾਹਰ ਖੇਡ ਲਿਆ ਕਰਨਗੇ ਜੀ ਦੋ ਘੰਟੇ ਫਰੈਸ਼ ਹੋਇਆ ਕਰਨਗੇ ਚਲੋ ਜੀ ਫਿਰ ਮਾਰਦਾ ਗੇੜਾ ਜੀ ਮੈਂ ਕੱਲ੍ਹ ਤੱਕ ਓਕੇ ਸਰ